ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਇੱਥੇ ਪਹੁੰਚ ਗਈ ਹਾਂ ਅਤੇ ਮੇਰੇ ਕੋਲ ਕੈਸ਼ ਹੈ ਨਹੀਂ ਅਗਰ ਤੁਹਾਡੇ ਕੋਲ ਫੋਨ ਪੇ ਗੂਗਲ ਪੇ ਜਾਂ ਪੇ ਟੀ ਐੱਮ ਕੁਝ ਵੀ ਚੱਲਦਾ ਆ ਤਾਂ ਪਲੀਜ਼ ਮੈਨੂੰ ਦਸ ਦਿਓ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਕਰ ਮਤਲਬ ਪੇਮੈਂਟ ਕਰ ਦਿੰਦੀ ਹਾਂ ਮੇਰੇ ਕੋਲ ਕੈਸ਼ ਹੈ ਨਹੀਂ ਮੈਂ ਤੁਹਾਨੂੰ ਤੁਸੀਂ ਮੈਨੂੰ ਆਪਣਾ ਨੰਬਰ ਮੋਬਾਈਲ ਨੰਬਰ ਦੇ ਦਿਓ ਯਾ ਅਕਾਊਂਟ ਨੰਬਰ ਦੇ ਦਿਓ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਕਰ ਦਿੰਦੀ ਹਾਂ ਹਾਂਜੀ ਪਲੀਜ਼ ਦੇ ਦਿਓ ਥੈਂਕ ਯੂ